ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਖੇਡਣ ਵਿੱਚ ਬਹੁਤ ਵੱਡਾ ਅੰਤਰ ਹੈ ਜਿਹੜੇ ਪਿੰਡ ਪਿੰਡਾਂ ਦੇ ਵਿੱਚ ਖੇਡਾਂ ਖੁੱਲ੍ਹੇ ਮੈਦਾਨਾਂ ਵਿੱਚ ਖੇਡੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਫੁੱਟਬੋਲ ਕ੍ਰਿਕਟ ਕਬੱਡੀ ਮੇਨ ਖੇਡਾਂ ਹਨ ਜਿਹੜੀਆਂ ਕਿ ਖੁੱਲ੍ਹੇ ਮੈਦਾਨਾਂ ਵਿੱਚ ਖੇਡੀਆਂ ਜਾਂਦੀਆਂ ਹਨ ਇਹ ਖੇਡਾਂ ਸਰੀਰਕ ਵਰਜਿਸ਼ ਵਾਸਤੇ ਖੇਡੀਆਂ ਜਾਂਦੀਆਂ ਹਨ ਜਿਹੜੇ ਕਿ ਸ ਜਿੰਨੇ ਵੀ ਪਲੇਅਰ ਹੋਏ ਹਨ ਉਹ ਪਿੰਡਾਂ ਦੇ ਵਿੱਚੋਂ ਉੱਠ ਕੇ ਨੈਸ਼ਨਲ ਲੈਵਲ ਤੱਕ ਦੇ ਪਲੇਅਰ ਪਿੰਡਾਂ ਦੇ ਵਿੱਚੋਂ ਹੀ ਬਣੇ ਹਨ ਅਤੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਹੜੀ ਸ਼ਹਿਰੀ ਪੱਧਰ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਉਹ ਬੰਦ ਕਮਰੇ ਦੇ ਵਿੱਚ ਖੇਡੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਖੇਡਾਂ ਹਨ ਲੂਡੋ ਚੈੱਸ ਅਤੇ ਕੈਰਮ ਬੋਰਡ ਆਦਿ ਖੇਡਾਂ ਇਹ ਸ਼ਹਿਰੀ ਖੇਤਰ ਦੀਆਂ ਖੇਡਾਂ ਵਿੱਚ ਆ ਜਾਂਦੀਆਂ ਹਨ ਅਤੇ ਇਸ ਸਾਰਾ ਹੀ ਇਸ ਦੇ ਵਿੱਚ ਦਿਮਾਗ਼ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਅਤੇ ਇਹ ਬੰਦ ਕਮਰਿਆਂ ਦੇ ਵਿੱਚ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਖੇਡਾਂ ਲੋਕੇਸ਼ਨ 'ਤੇ ਵੀ ਡੀਪੈਂਡ ਕਰਦੀਆਂ ਹਨ